ਭਾਸ਼ਾ ਇੱਕ ਮਾਧਿਅਮ ਹੈ ਜਿਹੜਾ ਆਪਣੀ ਭਾਵ ਹੈ ਦੂਜੇ ਤੱਕ ਪਹੁੰਚਾਉਣ ਦਾ ਉਹਦੇ ਲਈ ਪੰਜਾਬੀ ਹਿੰਦੀ ਉਰਦੂ ਇੰਗਲਿਸ਼ ਜਾਂ ਆਪਣੇ ਪੂਰੇ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਯੂਜ਼ ਹੁੰਦੀਆਂ ਅਤੇ ਨੋਰਮਲੀ ਪੰਜਾਬ ਦੇ ਵਿੱਚ ਜਿੰਨੇ ਪਾਪੂਲੇਸ਼ਨ ਹੈ ਉਹ ਨੋਰਮਲੀ ਪੰਜਾਬੀ ਭਾਸ਼ਾ ਯੂਜ ਕਰਦੇ ਐਂ ਪੰਜਾਬੀ ਭਾਸ਼ਾ ਵੀ ਸੰਪਰਕ ਦੀ ਲੋਕ ਸੰਪਰਕ ਭਾਸ਼ਾ ਹੈ ਜਿਹਦੇ ਵਿੱਚ ਨੋਰਮਲੀ ਅਸੀਂ ਸ਼ਬਦ ਜਿਹੜੇ ਆਪਣੇ ਪਿਆਰ ਦੇ ਨਾਲ਼ ਠਹਿਰਾਵ ਦੇ ਨਾਲ਼ ਬੋਲੇ ਜਾਂਦੇ ਹੈ ਅਤੇ ਇਹ ਭਾਸ਼ਾ ਦੀ ਵਰਤੋਂ ਜਿਹੜੀ ਹੈ ਉਹ ਨੋਰਮਲੀ ਅਸੀਂ ਆਪਸ 'ਚ ਗੱਲਬਾਤ ਕਰਨੀ ਸਕੂਲਾਂ ਦੇ ਵਿੱਚ ਕੋਲਜਿਸ ਦੇ ਵਿੱਚ ਘਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਇਹ ਯੂਜ ਹੁੰਦੀ ਹੈ ਅਤੇ ਭਾਸ਼ਾ ਦੀ ਵਰਤੋਂ ਉਸੇ ਤਰ੍ਹਾਂ ਹੀ ਜਿਵੇਂ ਬਾਕੀਆਂ ਭਾਸ਼ਾਵਾਂ ਦਾ ਹੁੰਦਾ ਇਸੇ ਤਰ੍ਹਾਂ ਹੀ ਇਹ ਭਾਸ਼ਾ ਦਾ ਜਿਹੜਾ ਹੈਗਾ ਯੂਸ ਇਸਤੇਮਾਲ ਕੀਤਾ ਜਾਂਦਾ ਹੈ ਵੀ ਇਹ ਇੱਕ ਭਾਵਨਾ ਦੂਜੇ ਤੱਕ ਪਹੁੰਚਾਉਣ ਦੀ ਜਿਹੜੀ ਗੱਲ ਹੈ ਭਾਵਨਾ ਹੈ ਉਹ ਪ੍ਰੋਪਰ ਸਹੀ ਢੰਗ ਨਾਲ਼ ਪਹੁੰਚ ਪਾਵੇ ਇਹੀ ਇਹ ਭਾਵ ਭਾਸ਼ਾ ਦਾ ਹੋਇਆ ਕਰਦਾ